ਮੈਨੂੰ ਲੱਗਦਾ ਹੈ ਕਿ ਵੱਡੀਆ ਸੰਸਥਾਵਾਂ ਜਿਵੇਂ ਕਿ ਆਈ ਆਈ ਟੀ ਆਈ ਆਈ ਐਸ ਸੀ ਅਤੇ ਆਈ ਆਈ ਐਮ ਸਭ ਲਈ ਕਫਾਇਤੀ ਹਨ ਆਈ ਆਈ ਐਸ ਸੀ ਦੀ ਸਥਾਪਨਾ ਉਨੀ ਸੌ ਨੌ ਵਿੱਚ ਉਦਯੋਗਪਤੀ ਜਸ਼ਮੇਦਦ ਜਮਸ਼ੇਦ ਜੀ ਨੂੰ ਸਵਰਾਜ ਜੀ ਟਾਟਾ ਮੈਸੂਰ ਰਾਜ ਪਰਿਵਾਰ ਅਤੇ ਭਾਰਤ ਦੇ ਸ ਭਾਰਤ ਸਰਕਾਰ ਦੇ ਵਿਚਕਾਰ ਇੱਕ ਦੂਰਦਰਸ਼ੀ ਸਾਂਝ ਦੁਆਰਾ ਕੀਤੀ ਗਈ ਸੀ ਆਈ ਟੀ ਆਈ ਆਈ ਟੀ ਵਿੱਚ ਉਪਲਬਧ ਪ੍ਰਮੁੱਖ ਧਾਰਾਵਾਂ ਗਿਆਨ ਅਤੇ ਇੰਜੀਨੀਅਰਿੰਗ ਅਤੇ ਤਕਨੋਲਜੀ ਹਨ ਆਈ ਆਈ ਟੀ ਵਿੱਚ ਉਪਲਬਧ ਪ੍ਰਮੁੱਖ ਧਾਰਾਵਾਂ ਹਨ ਸਿਵਲ ਕੰਪਿਊਂਟਰ ਸਾਇੰਸ ਅਤੇ ਟਕਨੋਲਜੀ ਮਕੈਨਿਕ ਇਲੈਕਟਰੀਕਲ ਇੰਜੀਨੀਅਰਿੰਗ ਕੈਮੀਕਲ ਇੰਜੀਨੀਅਰਿੰਗ ਅਤੇ ਹੋਰ ਬਹੁਤ ਕੁਝ ਹਨ ਆਈ ਆਈ ਆਈ ਟੀ ਦੁਆਰਾ ਪੇਸ਼ ਕੀਤੇ ਗਏ ਕੋਰਸਾਂ ਵਿੱਚ ਦਾਖਲਾ ਯੋਗਤਾ ਦੇ ਅਧੀਨ ਹਨ ਵਧਦੀ ਜਨਸੰਖਿਆ ਕਾਰਨ ਅੱਜ ਕੱਲ੍ਹ ਮੁਕਾਬਲੇ ਬਹੁਤ ਹੀ ਜ਼ਿਆਦਾ ਹੋ ਰਹੇ ਹਨ ਜੋ ਕਿ ਬੱਚੇ ਹਰ ਮੁਕਾਬਲੇ ਵਿੱਚ ਵਧੀਆ ਅਹੁਦਾ ਪ੍ਰਾਪਤ ਕਰਨਾ ਚਾਹੁੰਦੇ ਹਨ ਇਸ ਲਈ ਵਿਦਿਆਰਥੀ ਵੱਧ ਤੋਂ ਵੱਧ ਮਿਹਨਤ ਕਰਦੇ ਹਨ